ਮੇਰੀ ਰਾਜਨੀਤੀ ਅਤੇ ਰਾਜ ਭਲਾਈ ਵਾਲੀ ਖਬਰਾਂ ਵਿੱਚ ਅਹਿਮ ਰੁਚੀ ਰਹਿੰਦੀ ਹੈ ਇਸਦੇ ਨਾਲ ਨਾਲ ਮੌਜੂਦਾ ਅਫੇਅਰ ਦੀਆਂ ਖਬਰਾਂ ਨੂੰ ਵੀ ਮੈਂ ਨਿਰੰਤਰ ਫ਼ੋਲੋ ਕਰਦਾ ਰਹਿੰਦਾ ਹਾਂ ਜਿਸ ਨਾਲ ਮੈਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਸਾਡੇ ਦੇਸ਼ ਵਿੱਚ ਕਿਹੜੀ ਕਿਹੜੀ ਜਗ੍ਹਾ ਕੀ ਕੀ ਵਾਪਰ ਰਿਹਾ ਹੈ ਅਤੇ ਕੀ ਕੀ ਨਵੀਂ ਤਕਨੀਕੀ ਖੋਜਾਂ ਹੋ ਰਹੀਆਂ ਹਨ ਜਿਵੇਂ ਕਿ ਸਾਡੇ ਕੋਲਜ ਨੂੰ ਰਿਸੈਂਟ ਹੀ ਡੇਢ ਕਰੋੜ ਦੀ ਗ੍ਰਾਂਟ ਮਿਲੀ ਹੈ ਇਹ ਸਾਰੀਆਂ ਨਵੀਆਂ ਖਬਰਾਂ ਦਾ ਮੈਨੂੰ ਅਖਬਾਰਾਂ ਵਿੱਚੋਂ ਹੀ ਪਤਾ ਚੱਲਦਾ ਰਹਿੰਦਾ ਹੈ